ਮੈਂ ਸੁਨੀਲ ਕੁਮਾਰ ਪਿੰਡ ਮੈਂ ਜੈਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਉਸ ਸੰਬੰਧੀ ਕਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਨੰਬਰ ਇੱਕ 'ਤੇ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਉਸ ਦੇ ਆਂਡ ਗੁਆਂਢ ਸ਼ਰੀਕ ਭਾਈ ਉਸ ਦੇ ਪ੍ਰਦਖਨਾ ਕਰਦੇ ਹਨ ਅਤੇ ਮਰੇ ਹੋਏ ਬੰਦੇ ਦੇ ਜਿਹੜਾ ਘਰ ਦਾ ਵੱਡਾ ਮੈਂਬਰ ਹੋਏ ਧੀ ਪੁੱਤਰ ਉਸ ਨੂੰ ਚਿੱਟੇ ਕੱਪੜੇ ਪਵਾ ਕੇ ਮਤਲਬ ਕਿ ਭੂੰਗੀ ਉਸ 'ਤੇ ਬਨਾਈ ਦਿੱਤੀ ਜਾਂਦੀ ਹੈ ਫਿਰ ਉਹ ਆਪਨੇ ਚਾਰਜੀ ਨੂੰ ਫੋਨ ਕਰਕੇ ਅਤੇ ਬੁਲਾਇਆ ਜਾਂਦਾ ਹੈ ਤਾਂ ਚਾਰਜੀ ਇਹਨਾਂ ਰਸਮਾਂ ਬਾਰੇ ਸਾਨੂੰ ਦੱਸਦਾ ਰਹਿੰਦਾ ਹੈ ਕਿ ਕੀ ਕੁਛ ਕਰਨਾ ਹੈ ਉਸ ਤੋਂ ਬਾਅਦ ਉਸ ਮ੍ਰਿਤਕ ਨੂੰ ਨਹਾਇਆ ਜਾਂਦਾ ਹੈ ਨਹਾਉਣ ਤੋਂ ਬਾਅਦ ਉਸ ਦਾ ਇੱਕ ਫੱਟਾ ਤਿਆਰ ਕੀਤਾ ਜਾਂਦਾ ਹੈ ਉਸ ਫੱਟੇ ਉੱਤੇ ਉਸ ਬੰਦੇ ਮ੍ਰਿਤਕ ਨੂੰ ਲਿਟਾ ਕੇ ਤਾਂ ਸ਼ਮਸ਼ਾਨ ਘਾਟ ਲਿਆਇਆ ਜਾਂਦਾ ਹੈ ਲੇਨ ਤੋਂ ਬਾਅਦ ਉਸ ਬੰਦੇ ਦੇ ਸਾਰੇ ਜੋ ਵੀ ਸ਼ਰੀਕ ਭਾਈ ਜਾਂ ਭੈਣ ਭਰਾ ਹੁੰਦੇ ਹਨ ਉਹ ਪਿੱਛੇ ਮ੍ਰਿਤਕ ਦੇ ਪਿੱਛੇ ਜਾਂਦੇ ਹਨ ਅਤੇ ਉਸ ਨੂੰ ਜੋ ਬੰਦੇ ਚਾਰ ਜਣੇ ਚੁੱਕਣ ਵਾਲੇ ਹੁੰਦੇ ਹਨ ਉਹ ਉਸ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਲੈ ਜਾਂਦੇ ਹਨ ਅਤੇ ਰਸਤੇ ਵਿੱਚ ਅੱਧ ਰਸਤੇ ਵਿੱਚ ਜਿਹੜੇ ਅੱਗੇ ਬੰਦੇ ਲੱਗੇ ਹੁੰਦੇ ਉਹ ਪਿੱਛੇ ਆ ਜਾਂਦੇ ਹਨ ਜਿਹੜੇ ਪਿੱਛੇ ਲਗੇ ਉਹ ਅੱਗੇ ਲੱਗ ਜਾਂਦੇ ਹਨ ਅਤੇ ਉੱਥੇ ਘੜਾ ਤੋੜ ਦਿੱਤਾ ਜਾਂਦਾ ਹੈ ਅਤੇ ਮ੍ਰਿਤਕ ਨੂੰ ਮੜੀਆਂ ਵਿੱਚ ਲਿਜਾ ਦਿੱਤਾ ਜਾਂਦਾ ਹੈ ਅਤੇ ਉਸ ਅਤੇ ਜਗ੍ਹਾ ਨੂੰ ਸਫਾ ਸਫਾਈ ਕਰਕੇ ਅਤੇ ਉਸ ਨੂੰ ਉਸ ਥਾਂ 'ਤੇ ਰੱਖਿਆ ਜਾਂਦਾ ਹੈ ਧੰਨਵਾਦ